ਮੈਨੂੰ ਬਰਡ ਵਾਚਿੰਗ ਕਰਨਾ ਬਹੁਤ ਹੀ ਜਿਆਦਾ ਪਸੰਦ ਹੈ ਜਿਹਨੂੰ ਪੰਜਾਬੀ ਵਿੱਚ ਪੰਛੀਆਂ ਨੂੰ ਦੇਖਣਾ ਕਹਿੰਦੇ ਹਨ ਤੇ ਅੰਗਰੇਜ਼ੀ ਵਿੱਚ ਬਰਡ ਵਾਚਿੰਗ ਆਖਦੇ ਹਨ ਮੈਨੂੰ ਬਚਪਨ ਤੋਂ ਹੀ ਪੰਛੀਆਂ ਨੂੰ ਦੇਖਣ ਉਹਨਾਂ ਨੂੰ ਜਾਣਣ ਦਾ ਬਹੁਤ ਹੀ ਸ਼ੌਂਕ ਹੈ ਪੰਛੀਆਂ ਨੂੰ ਦੇਖਣ ਦੇਖਣਾ ਮੈਨੂੰ ਬਹੁਤ ਹੀ ਜਿਆਦਾ ਆਨੰਦ ਦਿੰਦਾ ਮੈਂ ਆਪਣੇ ਛੋਟਿਆਂ ਦਾ ਆਪਣੇ ਘਰ ਦੇ ਕੋਠੇ ਉੱਤੇ ਘਰ ਦੀ ਛੱਤ ਉੱਤੇ ਚੜ ਕੇ ਪੰਛੀਆਂ ਨੂੰ ਦੇਖਦੀ ਸੀਗੀ ਬਹੁਤ ਹੀ ਦੂਰ ਆਸਮਾਨ ਵਿੱਚ ਪੰਛੀ ਉੱਡਦੇ ਸਨ ਮੈਂ ਉਹਨਾਂ ਨੂੰ ਦੇਖਦੀ ਸੀਗੀ ਤੇ ਉਹਨਾਂ ਨੂੰ ਦੂਰੋਂ ਦੇਖਣਾ ਤਾ ਬਹੁਤ ਔਖਾ ਹੁੰਦਾ ਸੀ ਪਰ ਫਿਰ ਵੀ ਮੈਨੂੰ ਬਹੁਤ ਖੁਸ਼ੀ ਮਿਲਦੀ ਸੀ ਆਨੰਦ ਹੁੰਦਾ ਸੀਗਾ ਮੇਰੇ ਘਰਦਿਆਂ ਨੂੰ ਵੀ ਮੇਰੇ ਚਾਚਾ ਜੀ ਨੂੰ ਵੀ ਪਤਾ ਸੀਗਾ ਕਿ ਮੈਨੂੰ ਬਹੁਤ ਵਾਚਿੰਗ ਕ ਰਨਾ ਬਹੁਤ ਹੀ ਜਿਆਦਾ ਪਸੰਦ ਹ ਉਹ ਬਾਹਰ ਸੀਗੇ ਉਹਨਾਂ ਨੇ ਮੈਨੂੰ ਬਾਹਰੋਂ ਦੀ ਇੱਕ ਦੂਰਬੀਨ ਭੇਜਿਆ ਇੱਕ ਉਪਕਰਨ ਭੇਜਿਆ ਜਿਹਦੇ ਨਾਲ ਪੰਛੀ ਬਹੁਤ ਹੀ ਸਾਫ ਦਿਖਦੇ ਸੀਗੇ ਅਸਮਾਨ ਵਿੱਚ ਬਹੁਤ ਹੀ ਸਾਫ ਸੁਥਰੇ ਬਹੁਤ ਹੀ ਸੋਹਣੇ ਬਹੁਤ ਹੀ ਵਧੀਆ ਤਰੀਕੇ ਨਾਲ ਮੈਨੂੰ ਦਿਖਦੇ ਸੀਗੇ ਉਹ ਉਪਕਰਨ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆਇਆ ਉਹ ਮੇਰੇ ਚਾਚਾ ਜੀ ਨੇ ਮੈਨੂੰ ਬਾਹਰੋਂ ਭੇਜਿਆ ਸੀਗਾ ਸਪੈ ਪੰਛੀਆਂ ਨੂੰ ਦੇਖਣ ਲਈ ਬਾਹਰੋਂ ਭੇਜਿਆ ਸੀਗਾ ਓਹ ਮੇਰੇ ਚਾਚਾ ਜੀ ਨੇ ਉਹ ਮੈਨੂੰ ਬਹੁਤ ਹੀ ਜਿਆਦਾ ਪਸੰਦ ਸੀਗਾ ਫਿਰ ਉਹਦੇ ਰਾਹੀਂ ਮੈਂ ਆਪਣੇ ਘਰ ਦੀ ਛੱਤ ਉਤੇ ਚੜ ਕੇ ਪੰਛੀਆਂ ਨੂੰ ਦੇਖਦੀ ਸੀ ਤੇ ਆਨੰਦ ਪ੍ਰਾਪਤ ਕਰਦੀ ਸੀਗੀ ਇਹ ਦੂਰਬੀਨ ਇਹ ਉਪਕਰਨ ਨੂੰ ਘਰ ਵਿੱਚ ਨਹੀਂ ਬਣਾਇਆ ਜਾ ਸਕਦਾ ਹੈ ਇਹ ਬਹੁਤ ਹੀ ਜਿਆਦਾ ਔਖਾ ਹੁੰਦਾ ਇਹ ਸਿਰਫ ਸਾਇੰਟੀਫਿਕ ਦੀ ਹੀ ਬਣ ਸਕਦਾ ਸਾਇੰਟਿਸਟ ਹੀ ਬਣਾ ਸਕਦੇ ਦੂਰਬੀਨ ਇਹ ਉਪਕਰਨ ਘਰ ਵਿੱਚ ਨਹੀਂ ਬਣਾਇਆ ਜਾ ਸਕਦਾ ਘਰ ਵਿੱਚ ਬਣਾਉਣਾ ਇਹਨੂੰ ਔਖਾ ਹੁੰਦਾ ਘਰ ਵਿੱਚ ਇਦਾਂ ਦੇ ਚੀਜ਼ਾਂ ਨਹੀਂ ਬਣਾਈਆਂ ਜਾ ਸਕਦੀਆਂ ਇਦਾਂ ਦੇ ਉਪਕਰਨ ਨਹੀਂ ਬਣਾਏ ਜਾ ਸਕਦੇ ਘਰ ਦੇ ਵਿੱਚ ਪਰ ਪੰਛੀਆਂ ਨੂੰ ਦੇਖਣਾ ਮੈਨੂੰ ਬਹੁਤ ਹੀ ਜਿਆਦਾ ਪਸੰਦ ਹ ਇਸ ਕਰਕੇ ਮੈਂ ਉਸ ਉਹ ਉਪਕਰਨ ਰਾਹੀ ਦੂਰਬੀਨ ਰਾਹੀਂ ਪੰਛੀਆਂ ਨੂੰ ਦੇਖਦੀ ਸੀ ਪਰ ਇਹ ਉਪਕਰਨ ਘਰ ਨਹੀਂ ਬਣਾਇਆ ਜਾ ਸਕਦਾ